ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਤੁਸੀਂ ਕਿਥੋਂ ਫਰੀਦਕੋਟ ਤੋਂ ਬੋਲਦੇ ਹੋ ਬਲਜੀਤ ਕੌਰ ਨਿਰਮਲ ਸਿੰਘ ਦੀ ਵਾਈਫ ਅੱਛਾ ਓਕੇ ਓਕੇ ਹਾਂਜੀ ਕਿਵੇਂ ਤੁਸੀਂ ਠੀਕ ਹੋ ਹੁਣ ਜਿਵੇਂ ਹੁਣ ਤੁਸੀਂ ਮੈਡੀਸਨ ਵਗੈਰਾ ਲੈ ਰਹੇ ਹੋ ਪ੍ਰੋਪਰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਨੇ ਦੱਸਿਆ ਸੀ ਮੈਨੂੰ ਅਤੇ ਹਾਂਜੀ ਹਾਂਜੀ ਹਾਂਜੀ ਐਗ ਹੋ ਗਿਆ ਫਿਸ ਹੋ ਗਿਆ ਇਹ ਖਾਓ ਜਿੰਨਾ ਖਾਓਗੇ ਤੁਹਾਡੀ ਸਿਹਤ ਨੀ ਠੀਕ ਰਹੇਗੀ ਮਤਲਬ ਪਰਹੇਜ਼ ਕਰਿਆ ਕਰੋ ਕਿ ਇੱਦਾਂ ਦੀ ਚੀਜ਼ ਖਾਓ ਪਰਹੇਜ਼ ਕਰੋ ਜਿਹੜੀ ਚੀਜ਼ ਤੁਹਾਨੂੰ ਇੰਨਫੈਕਸ਼ਨ ਹੁੰਦੀ ਉਹ ਘੱਟ ਖਾਓ ਜਿੱਦਾਂ ਤੁਸੀਂ ਜਿਵੇਂ ਹੁਣ ਜਿਹੜਾ ਤੁਹਾਨੂੰ ਨੋਰਮਲ ਆਟਾ ਹੁੰਦਾ ਆਪਣਾ ਵੀਟ ਉਹ ਤੁਸੀਂ ਨਹੀਂ ਖਾਣਾ ਬਿਲਕੁਲ ਵੀ ਨਹੀਂ ਖਾਣਾ ਉਹ ਮਲਟੀ ਵਿਟਾਮਿਨ ਗ੍ਰੀਨ ਵਾਲਾ ਆਟਾ ਖਾ ਲਓ ਜਾਂ ਤੁਸੀਂ ਆਪਣਾ ਪਿਸ ਵੀ ਅਲੱਗ ਤੋਂ ਚੱਕੀ ਤੋਂ ਪਿਹਾਅ ਲਓ ਉਹਦੇ 'ਚ ਆਪਣਾ ਮਿਕਸ ਕਰਕੇ ਜਿਹੜੇ ਤੁਹਾਨੂੰ ਦਾਲਾਂ ਵਗੈਰਾ ਅੱਛੇ ਲੱਗਦੇ ਉਹਨਾਂ ਦਾ ਆਟਾ ਬਣਵਾ ਲਓ ਹੈ ਨਾ ਇੱਦਾਂ ਬਣਵਾ ਕੇ ਖਾ ਲਿਆ ਕਰੋ ਹਾਂ ਇਹ ਤਾਂ ਹੈ ਨਹੀਂ ਨਹੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਤੁਸੀਂ ਵੱਧ ਤੋਂ ਵੱਧ ਫਰੂਟ ਲਿਆ ਕਰੋ ਮੋਰਨਿੰਗ ਟਾਈਮ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਫਰੂਟ ਲਿਆ ਕਰੋ ਜਿਹੜਾ ਤੁਹਾਨੂੰ ਜ਼ਿਆਦਾ ਪਸੰਦ ਹੈ ਉਹ ਫਰੂਟ ਜ਼ਿਆਦਾ ਖਾ ਲਿਆ ਕਰੋ ਠੀਕ ਹੈ ਜੇ ਤੁਹਾਨੂੰ ਨਹੀਂ ਐਪਲ ਹਾਂਜੀ ਹਾਂਜੀ ਹਾਂਜੀ ਉਹ 'ਚ ਵੱਧ ਹੁੰਦੀ ਆ ਹਾਂਜੀ ਹਾਂਜੀ ਐਪਲ ਵਗੈਰਾ ਖਾਇਆ ਕਰੋ ਐਪਲ ਹੋ ਗਿਆ ਪੋਮੀਗਰੇਟ ਹੋ ਗਿਆ ਅਨਾਰ ਵਗੈਰਾ ਖਾਇਆ ਕਰੋ ਉਹਦੇ ਨਾਲ ਐਂ ਕਿ ਤੁਹਾਡਾ ਬਲੱਡ ਦਾ ਜਿਹੜਾ ਉਹ ਵੀ ਵਧੀਆ ਰਹੂਗਾ ਅਤੇ ਅਮਰੂਦ ਖਾਇਆ ਕਰੋ ਉਹਦੇ ਨਾਲ ਤੁਹਾਡਾ ਪੇਟ ਸਾਫ਼ ਰਿਹਾ ਕਰੂਗਾ ਰਾਤ ਨੂੰ ਜੀ ਸੋਣ ਲੱਗੇ ਤੁਸੀਂ ਅਮਰੂਦ ਲ ਖਾਓਂਗੇ ਨਾ ਰੋਟੀ ਖਾਣ ਤੋਂ ਬਾਅਦ ਤਾਂ ਸੁਬਹਾ ਤੁਹਾਡਾ ਜਿਹੜੀ ਇਨਫੈਕਸ਼ਨ ਵਗੈਰਾ ਪੇਟ ਸਾਫ਼ ਅੱਛੀ ਤਰ੍ਹਾਂ ਹੋਵੇਗਾ ਤਾਂ ਉਹਦੇ ਨਾਲ ਇਨਫੈਕਸ਼ਨ ਘੱਟ ਹੋਇਆ ਕਰੂਗੀ

ਪਾਸ ਹੁੰਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਨਹੀਂ ਤੁਹਾਨੂੰ ਤੁਸੀਂ ਜਿਹੜੀ ਦਵਾਈ ਫਰੀਦਕੋਟ ਤੋਂ ਲਿੱਤੀ ਹੈ ਉਹਨੇ ਥ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਈ ਫਿਰ ਕੋਈ ਗੱਲ ਨਹੀਂ ਵੈਸੇ ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਫਿਰ ਤੁਸੀਂ ਨਾ ਲਓ ਕਿਉਂਕਿ ਜਿ ਹਾਂਜੀ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਸੁੰਢ ਵਗੈਰਾ ਪੈਂਦੀ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਨਹੀਂ ਵਧ ਨਹੀਂ ਇਹ ਤਾਂ ਗੱਲ ਦੇਖੋ ਜੇ ਤੁਸੀਂ ਦੱਸੋਗੇ ਸਾਨੂੰ ਫਿਰ ਹੀ ਪਤਾ ਲੱਗੇਗਾ ਕਿ ਤੁਹਾਨੂੰ ਕੀ ਪ੍ਰੋਬਲਮ ਹੈ ਅਤੇ ਦੂਸਰੀ ਇਹ ਬਸ ਪਰਹੇਜ਼ ਹੀ ਆ ਤੁਹਾਡੇ ਕਿ ਵੱਧ ਤੋਂ ਵੱਧ ਜਿਹੜੀ ਚੀਜ਼ਾਂ ਤੁਹਾਨੂੰ ਮਨਾ ਕੀਤੀਆਂ ਗਈਆਂ ਮੈਮ ਵੱਲੋਂ ਉਹ ਤੁਸੀਂ ਨਾ ਖਾਓਂਗੇ ਤਾਂ ਚੰਗੇ ਰਹੋਗੇ ਕਿਉਂਕਿ ਜੇ ਤੁਸੀਂ ਖਾਓਂਗੇ ਨਾ ਉਹ ਕੰਮ ਵੱਧ ਜ਼ਿਆਦਾ ਵੱਧ ਜਾਵੇਗਾ ਠੀਕ ਹੈ ਉਸ ਦੇ ਹਿਸਾਬ ਨਾਲ ਜਿਹੜੀ ਤੁਹਾਨੂੰ ਵੱਧ ਤੋਂ ਵੱਧ ਤੁਸੀਂ ਜਿਵੇਂ ਆਹਾ ਵੱਧ ਤੋਂ ਵੱਧ ਜਿਵੇਂ ਜਿੰਨਾ 'ਚ ਜ਼ਿਆਦਾ ਪ੍ਰੋਟੀਨ ਉਹ ਖਾਓ ਕਿ ਜਿਹੜਾ ਕਿ ਤੁਹਾਡੀ ਜਿਹੜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਨਹੀਂ ਤੁਸੀਂ ਵੱਧ ਤੋਂ ਵੱਧ ਖਾਇਆ ਕਰੋ ਬਸ ਐਂ ਨਾ ਹੌਲੀ ਹੌਲੀ ਤੁਹਾਨੂੰ ਆਦਤ ਪੈ ਜੂਗੀ ਜਿਵੇਂ ਜਿਵੇਂ ਤੁਸੀਂ ਖਾਓਂਗੇ ਤੁਹਾਨੂੰ ਟੇਸਟ ਪੈ ਜੂਗਾ ਉਹਦਾ ਤਾਂ ਫਿਰ ਤੁਹਾਡਾ ਆਪਣਾ ਜੀ ਕਰੂਗਾ ਖਾਣ ਨੂੰ ਆਦਤ ਪਾਓ ਤੁਸੀਂ ਹੋਲੀ ਹੋਲੀ ਜਿਵੇਂ ਇੱਕ ਜਿਵੇਂ ਇੱਕ ਸੁਬਾਹ ਲੈ ਲਿਆ ਇੱਕ ਦੁਪਹਿਰੇ ਇੱਕ ਸ਼ਾਮ ਨੂੰ ਲੈ ਲਓ ਰਾਤ ਨੂੰ ਸੋਣ ਲੱਗੇ ਲੈ ਲਓ ਵੀ ਉਹ ਜਿਵੇਂ ਮਰਜ਼ੀ ਬਣਾ ਕੇ ਖਾ ਲਓ ਇਹ ਨਹੀਂ ਹੈਗਾ ਵੀ ਉਹਨੂੰ ਉਬਾਲ ਕੇ ਹੀ ਖਾਣਾ ਤੁਸੀਂ ਜਿਵੇਂ ਅੱਜ ਕੱਲ੍ਹ ਆਹਾ ਤਵੇ 'ਤੇ ਆਮਲੇਟ ਬਣਾ ਕੇ ਖਾ ਲਿਓ ਠੀਕ ਹੈ ਜਿਵੇਂ ਠੀਕ ਹੈ ਅਤੇ ਜਿਵੇਂ ਤੁਹਾਨੂੰ ਹਾਂ ਤੁਸੀਂ ਇੱਕ ਵਾਰ ਆ ਜਾਇਓ ਆ ਕੇ ਮੈਮ ਨਾਲ ਗੱਲ ਕਰ ਲਿਓ ਇੱਕ ਵਾਰ ਫਿਰ ਰਿਪੋਰਟ ਲਿਆਇਓ ਉਹ ਰਿਪੋਰਟ ਨੂੰ ਵੇਖ ਕੇ ਫਿਰ ਨਵੀਂ ਉਹ ਬਣਾਵਾਂਗੇ ਤੁਹਾਨੂੰ ਠੀਕ ਹੈ ਠੀਕ ਹੈ ਓਕੇ ਥੈਂਕ ਯੂ